ਮੇਰਾ ਨਾਮ ਮੋਨਿਕਾ ਹੈ ਅੱਜ ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਕਿਤੇ ਘੁੰਮਣ ਜਾਣ ਦੀ ਪਲੈਨਿੰਗ ਕੀਤੀ ਅਸੀਂ ਸਾਰੇ ਜਣੇ ਨੇ ਸੋਚਿਆ ਕਿ ਅੱਜ ਅਸੀਂ ਅੰਮ੍ਰਿਤਸਰ ਘੁੰਮਣ ਜਾਂਦੇ ਹਨ ਉੱਥੇ ਅਸੀਂ ਜਾ ਕੇ ਦੇਖਿਆ ਕਿ ਉੱਥੇ ਹਰਿਮੰਦਰ ਸਾਹਿਬ ਗੁਰਦੁਆਰਾ ਅਤੇ ਹੋਰ ਵੀ ਕਈ ਸਾਰੇ ਗੁਰਦੁਆਰੇ ਸਨ ਅਸੀਂ ਹਰਿਮੰਦਰ ਸਾਹਿਬ ਗੁਰਦੁਆਰੇ ਵਿੱਚ ਮੱਥਾ ਟੇਕਣ ਗਏ ਉੱਥੇ ਬਹੁਤ ਹੀ ਜ਼ਿਆਦਾ ਭੀੜ ਲੱਗੀ ਹੋਈ ਸੀ ਉੱਥੇ ਹਰ ਦਿਨ ਰਾਤ ਭੀੜ ਹੀ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਰੌਣਕ ਰਹਿੰਦੀ ਹੈ ਉਸ ਜਗ੍ਹਾ 'ਤੇ ਹਮੇਸ਼ਾ ਸਫਾਈ ਤੋਂ ਸਫਾਈ ਬਾਹਰ ਸਫਾਈ ਅੰਦਰ ਸਫਾਈ ਅਤੇ ਉਸਦੇ ਨਾਲ ਦੇ ਏਰੀਏ ਵਿੱਚ ਸਫਾਈ ਰਹਿੰਦੀ ਹੈ ਅਤੇ ਉੱਥੇ ਲੰਗਰ ਵੀ ਬਹੁਤ ਵਧੀਆ ਲੱਗਿਆ ਹੁੰਦਾ ਹੈ ਅਸੀਂ ਅੱਜ ਕਿਹਾ ਅਸੀਂ ਮੰਦਰ ਸਾਹਿਬ ਦੇ ਹਰਿਮੰਦਰ ਸਾਹਿਬ ਦੇ ਗੁਰਦੁਆਰੇ ਦੇ ਵਿੱਚ ਅੱਜ ਅਸੀਂ ਸਾਰਿਆਂ ਨੇ ਲੰਗਰ ਛਕਣਾ ਹੈ ਅਸੀਂ ਲੰਗਰ ਵਿੱਚ ਖਾ ਕੇ ਦੇਖਿਆ ਤਾਂ ਲੰਗਰ ਬਹੁਤ ਹੀ ਸਵਾਦ ਬਣਿਆ ਹੋਇਆ ਸੀ ਅਤੇ ਅਸੀਂ ਦੇਖਿਆ ਉਸ ਵਿੱਚ ਸਾਡੇ ਪੰਜਾਬ ਨਾਲ ਰਿਲੇਟਿਡ ਕੁਝ ਕਿਸਮਾਂ ਜਿਵੇਂ ਕਿ ਸਾਗ ਮੱਕੀ ਦੀ ਰੋਟੀ ਆਲੂ ਗੋਭੀ ਦੀ ਸਬਜ਼ੀ ਅਤੇ ਮਿੱਠੇ ਵਿੱਚ ਖੀਰ ਬਣੀ ਹੋਈ ਸੀ ਅਤੇ ਹੋਰ ਵੀ ਕਈ ਪ੍ਰਕਾਰ ਦੀਆਂ ਸਬਜ਼ੀਆਂ ਬਣੀਆਂ ਹੋਈਆਂ ਸਨ ਜੋ ਕਿ ਬਹੁਤ ਹੀ ਸਵਾਦ ਲੱਗੀਆਂ ਅਤੇ ਮੇਰੇ ਘਰਦਿਆਂ ਨੇ ਵੀ ਖੁਸ਼ ਹੋ ਕੇ ਖਾਧੀ ਅਸੀਂ ਅੱਜ ਹਰਿਮੰਦਰ ਸਾਹਿਬ ਦੇ ਬਾਹਰ ਵੀ ਜਾ ਕੇ ਕੁਝ ਖਰੀਦਣਾ ਚਾਹਿਆ ਉੱਥੇ ਗੁਰੂਆਂ ਦੀਆਂ ਫੋਟੋਆਂ ਅਤੇ ਹੋਰ ਵਗੈਰਾ ਸਮਾਨ ਵੇਚਿਆ ਜਾਂਦਾ ਸੀ ਅਸੀਂ ਆਪਣੇ ਘਰ ਲਈ ਇੱਕ ਵਾਪਸ ਆਉਣ ਲੱਗੇ ਗੁਰੂ ਹਰਿਮੰਦਰ ਸਾਹਿਬ ਜੀ ਦੀ ਫੋਟੋ ਲਿੱਤੀ ਅਤੇ ਉਹ ਸਾਨੂੰ ਲੈ ਕੇ ਬਹੁਤ ਹੀ ਵਧੀਆ ਲੱਗਿਆ